ਲਾਕਡਾਊਨ ਦੇ ਟਾਈਮ ਲੋਕਾਂ ਨੇ ਮੋਬਾਇਲ ਅਤੇ ਲੈਪਟਾਪ ਦਾ ਬਹੁਤ ਹੀ ਜ਼ਿਆਦਾ ਪ੍ਰਯੋਗ ਕੀਤਾ ਹੈ ਤਾਂ ਉਸ ਟਾਈਮ ਇਹ ਮਜਬੂਰੀ ਬਣ ਗਈ ਸੀ ਕਿ ਕਿਸੇ ਵੀ ਵਿਅਕਤੀ ਨੇ ਘਰ ਤੋਂ ਬਾਹਰ ਨਹੀਂ ਜਾਣਾ ਇਸ ਲਈ ਸਰਕਾਰ ਨੇ ਵੀ ਇਹ ਐਲਾਨ ਕਰ ਦਿੱਤਾ ਸੀ ਕਿ ਜੋ ਵੀ ਤੁਸੀਂ ਕੰਮ ਕਰਨਾ ਹੈ ਉਹ ਘਰ ਬੈਠੇ ਹੀ ਕਰਨਾ ਹੈ ਕੋਈ ਵੀ ਸਿੱਖਿਆ ਦੇ ਨਾਲ ਸੰਬੰਧਿਤ ਹੋ ਜਾਂ ਕੰਮ ਦੇ ਨਾਲ ਸੰਬੰਧਿਤ ਹੈ ਤਾਂ ਉਹ ਘਰ ਬੈਠੇ ਹੀ ਕਰਨਾ ਹੈ ਉਸ ਟਾਈਮ ਬਹੁਤ ਹੀ ਜ਼ਿਆਦਾ ਆਨਲਾਈਨ ਸਟੱਡੀ ਜ਼ਿਆਦਾ ਦਿੱਤੀ ਜਾਂਦੀ ਸੀ ਤਾਂ ਕਿ ਬੱਚੇ ਬਾਹਰ ਨਾ ਆਉਣ ਕੋਈ ਵੀ ਸਟੱਡੀ ਰਿਲੇਟਿਡ ਟੋਪਿਕ ਬੱਚਿਆਂ ਦੀ ਆਨਲਾਈਨ ਜੂਮ ਮੀਟਿੰਗ ਦੁਆਰਾ ਕਰ ਦਿੱਤੀ ਜਾਂਦੀ ਸੀ ਕੁਝ ਸਕੂਲਾਂ ਵਿੱਚ ਪੇਪਰ ਵੀ ਆਨਲਾਈਨ ਹੀ ਲਏ ਜਾਂਦੇ ਸਨ ਅਤੇ ਕੁਝ ਜੋ ਆਫਿਸ ਵਾਲੇ ਵਰਕ ਹਨ ਉਹ ਵੀ ਘਰ ਵਿੱਚ ਹੀ ਕੀਤੇ ਜਾਂਦੇ ਸਨ ਆਨਲਾਈਨ ਵਰਕ ਲਾਕਡਾਊਨ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਖੁਦ ਦੇ ਆਨਲਾਈਨ ਵਰਕ ਸ਼ੁਰੂ ਕੀਤੇ ਸਨ ਤਾਂ ਕਿ ਸਾਰੇ ਜੋ ਘਰ ਵਿੱਚ ਬੈਠੇ ਬੇਰੋਜ਼ਗਾਰ ਹਨ ਉਹਨਾਂ ਨੂੰ ਵੀ ਕੰਮ ਮਿਲ ਸਕੇ ਇਹ ਉਸ ਲੋਕਡਾਈਨ ਲਾਕਡਾਊਨ ਤੋਂ ਹੀ ਜ਼ਿਆਦਾ ਆਨਲਾਈਨ ਕੰਮ ਸ਼ੁਰੂ ਕੀਤਾ ਗਿਆ ਅਤੇ ਅੱਜ ਕੱਲ੍ਹ ਦੀ ਜਨਰੇਸ਼ਨ ਵਿੱਚ ਆਫਲਾਈਨ ਕੰਮ ਨਾਲੋਂ ਜ਼ਿਆਦਾ ਆਨਲਾਈਨ ਕੰਮ ਦੀ ਹੀ ਜ਼ਿਆਦਾ ਡਿਮਾਂਡ ਹੈ ਅੱਜ ਕੱਲ੍ਹ ਦੇ ਬੱਚੇ ਚਾਹੁੰਦੇ ਹਨ ਕਿ ਵੀ ਸਾਨੂੰ ਆਨਲਾਈਨ ਕੰਮ ਘਰ ਬੈਠੇ ਹੀ ਮਿਲ ਜਾਏ ਤਾਂ ਕਿ ਸਾਨੂੰ ਜ਼ਿਆਦਾ ਭੱਜ ਦੌੜ ਨਾ ਕਰਨੀ ਪਵੇ ਇਹ ਲਾਕਡਾਊਨ ਸਮੇਂ ਇਹ ਆਨਲਾਈਨ ਕੰਮ ਸੀ ਜੋ ਸਾਨੂੰ ਕਈ ਵਾਰ ਮੋਬਾਇਲ ਅਤੇ ਲੈਪਟੋਪ 'ਤੇ ਕਰਨਾ ਹੁੰਦਾ ਸੀ ਇਹ ਸਾਡੇ ਲਈ ਬਹੁਤ ਹੀ ਸ ਸਹਾਇਕ ਅਤੇ ਫਾਇਦੇਮੰਦ ਵੀ ਸੀ ਕਿਉਂਕੀ ਸਾਨੂੰ ਡੇਲੀ ਡੇਲੀ ਅਪ ਡਾਊਨ ਨਹੀਂ ਕਰਨਾ ਪੈਂਦਾ ਸੀ ਔਨਲਾਈਨ ਕੰਮ ਸਾਡੇ ਲਈ ਬਹੁਤ ਹੀ ਸਹਾਇਕ ਰਿਹਾ ਇਸ ਦਾ ਤਜਰਬਾ ਅਸੀਂ ਖੁਦ ਵੀ ਕੀਤਾ ਹੈ ਅਸੀਂ ਆਨਲਾਈਨ ਕੰਮ ਕਰਕੇ ਕੁਝ ਪੈਸੇ ਵੀ ਕਮਾਏ ਹਨ ਅਤੇ ਆਪਣੇ ਆਸੇ ਪਾਸੇ ਦੇ ਜੋ ਲੋਕ ਹਨ ਉਹਨਾਂ ਨੂੰ ਵੀ ਇਸ ਬਾਰੇ ਦੱਸਿਆ